ਮੇਰੇ ਦੌੜਨ ਦਾ ਸਭ ਤੋਂ ਪਸੰਦੀਦਾ ਸਥਾਨ ਸ਼ਹੀਦ ਭਗਤ ਸਿੰਘ ਪਾਰਕ ਹੈ ਮੈਂ ਜਿੱਥੇ ਰੋਜ਼ ਸ਼ਾਮ ਨੂੰ ਦੌੜਨ ਲਈ ਜਾਂਦਾ ਹਾਂ ਇੱਥੇ ਪਾਰਕ ਦੇ ਵਿੱਚ ਇੱਕ ਪਾਸੇ ਦੌੜਨ ਲਈ ਟਰੈਕ ਵੀ ਬਣਿਆ ਹੋਇਆ ਹੈ ਜੋ ਬਹੁਤ ਸੁੰਦਰ ਅਤੇ ਸਾਫ ਹੈ ਇੱਥੇ ਹੋਰ ਵੀ ਨੌਜਵਾਨ ਦੌੜਦੇ ਹਨ ਪਰ ਮੈਂ ਜ਼ਿਆਦਾ ਤੌਰ 'ਤੇ ਇਕੱਲਾ ਹੀ ਇੱਥੇ ਦੌੜਨ ਲਈ ਜਾਂਦਾ ਹਾਂ ਕਿਉਂਕਿ ਮੈਨੂੰ ਇਕੱਲੇ ਦੌੜਨ ਵਿੱਚ ਹੀ ਆਨੰਦ ਮਹਿਸੂਸ ਹੁੰਦਾ ਹੈ ਅਤੇ ਇਕੱਲਾ ਤੁਸੀਂ ਆਪਣਾ ਚੰਗੀ ਤਰ੍ਹਾਂ ਦੌੜ ਦੌੜ ਸਕਦੇ ਹੋ ਜੇਕਰ ਆਪਾਂ ਕਿਸੇ ਨੂੰ ਨਾਲ ਲੈ ਜਾਂਦੇ ਹਾਂ ਤਾਂ ਕਈ ਵਾਰ ਆਪਸ ਵਿੱਚ ਆਪਾਂ ਗੱਲਾਂ ਕਰਨ ਲੱਗ ਜਾਂਦੇ ਹਾਂ ਜੋ ਕਿ ਤੁਹਾਡੀ ਐਕਸਰਸਾਈਜ ਕਰਨ ਲਈ ਜਾਂ ਦੌੜਨ ਦੇ ਸਮੇਂ ਵਿੱਚ ਸਹਾਇਕ ਦੌੜਨ ਦੇ ਸਮੇਂ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਇਸ ਕਰਕੇ ਮੈਂ ਹਮੇਸ਼ਾ ਇਕੱਲਾ ਹੀ ਦੌੜਦਾ ਹਾਂ ਅਤੇ ਮੈਂ ਇੱਥੇ ਇੱਕ ਘੰਟਾ ਦੌੜਦਾ ਹਾਂ ਉਸ ਤੋਂ ਬਾਅਦ ਮੈਂ ਜੋਗਿੰਗ ਕਰਦਾ ਹਾਂ ਕਸਰਤਾਂ ਕਰਦਾ ਹਾਂ ਅਤੇ ਹੋਰ ਵੀ ਇੱਕ ਨਾਲ ਯੋਗਾ ਵੀ ਕਰਦਾ ਹਾਂ ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ ਯੋਗਾ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਹਰ ਇੱਕ ਇਨਸਾਨ ਨੂੰ ਦੌੜਨਾ ਬਹੁਤ ਜ਼ਰੂਰੀ ਹੈ ਇਹ ਵੀ ਇੱਕ ਤਰ੍ਹਾਂ ਦਾ ਯੋਗਾ ਹੀ ਹੁੰਦਾ ਹੈ ਜਿਸ ਵਿੱਚ ਸਾਡੇ ਸਰੀਰ ਦੇ ਹਰ ਇੱਕ ਅੰਗ ਦੀ ਐਕਸਰਸਾਈਜ ਹੋ ਜਾਂਦੀ ਹੈ